ਸਤਿ ਸ਼੍ਰੀ ਅਕਾਲ ਜੀ ਸ਼੍ਰੀਮਾਨ ਜੀ ਤੁਸੀਂ ਸਨੀ ਗਾਰਮੈਂਟ ਤੋਂ ਗੱਲ ਕਰ ਰਹੇ ਹੋ ਮੈਂ ਤੁਹਾਡੇ ਕੋਲੋਂ ਦਸ ਦਿਨ ਪਹਿਲਾਂ ਦਾ ਕੱਪੜਿਆਂ ਦਾ ਔਡਰ ਕੀਤਾ ਸੀ ਜੋ ਮੈਨੂੰ ਸਮੇਂ ਸਿਰ ਮਿਲ ਗਿਆ ਹੈ ਇਹਨਾਂ ਕੱਪੜਿਆਂ ਨਾਲ਼ ਤੁਸੀਂ ਮੈਨੂੰ ਕੂਪਨ ਵੀ ਦਿੱਤਾ ਸੀ ਮੈਨੂੰ ਤੁਹਾਡੇ ਕੱਪੜੇ ਬਹੁਤ ਪਸੰਦ ਆਏ ਹਨ ਮੈਂ ਹੁਣ ਤੁਹਾਡੇ ਕੋਲੋਂ ਕੁਝ ਹੋਰ ਕੱਪੜੇ ਚਾਰ ਪੈਂਟਾਂ ਦੋ ਕਮੀਜ਼ਾਂ ਮੰਗਵਾਉਣਾ ਚਾਹੁੰਦਾ ਹਾਂ ਅਤੇ ਇਸ ਇਸ ਆਡਰ ਵਿੱਚ ਤੁਸੀਂ ਮੈਨੂੰ ਦਿੱਤੇ ਕੂਪਨ ਦੀ ਛੋਟ ਵੀ ਦੇ ਦਿਓ